ਹਾਲੇ ਹਾਲੇ ਹੀ ਮੈਂ ਇੱਕ ਪ੍ਰੋਡਕਟ ਐਮੇਜ਼ੋਨ ਤੋਂ ਮੰਗਵਾਇਆ ਜੋ ਕਿ ਸੀ ਸੀ ਟੀ ਵੀ ਕੈਮਰਾ ਉਹ ਮੇਰੇ ਵਾਸਤੇ ਇੰਨਾ ਕੁ ਜ਼ਿਆਦਾ ਈਜ਼ੀ ਹੋ ਗਿਆ ਕੰਮ ਜਿਹੜੀ ਜਿਹੜੀ ਚੀਜ਼ਾਂ ਉਹਦੇ 'ਚ ਮੈਨੂੰ ਦੱਸੀਆਂ ਗਈਆਂ ਸੀ ਉਹਦੇ ਤੋਂ ਵੀ ਜ਼ਿਆਦਾ ਮੈਨੂੰ ਸਹੂਲਤਾਂ ਉਹਦੇ ਤੋਂ ਮਿਲੀਆਂ ਮੈਨੂੰ ਇਹ ਵਾਲਾ ਪ੍ਰੋਡਕਟ ਲੈ ਕੇ ਇੰਨੀ ਜ਼ਿਆਦਾ ਸੈਟਿਸਫੈਕਸ਼ਨ ਅਸੀਂ ਕਹਿ ਸਕਦੇ ਹਾਂ ਹੋਈ ਹੈ ਕਿ ਮਤਲਬ ਮੇਰਾ ਕਿੰਨਾ ਕੰਮ ਈਜ਼ੀ ਹੋ ਗਿਆ ਇਹਦੇ ਪ੍ਰੋਡਕਟ ਦੇ ਆਉਣ ਦੇ ਕਾਰਨ